ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਖੂਹ ਵਿੱਚੋਂ ਪਾਣੀ ਬਾਲਟੀ ਅਤੇ ਰੱਸੀ ਰਾਹੀਂ ਕੱਢਿਆ ਜਾਂਦਾ ਹੈ ਬਾਲਟੀ ਰਾਹੀਂ ਇਸ ਤਰ੍ਹਾਂ ਕੱਢਿਆ ਜਾਂਦਾ ਹੈ ਕਿ ਜੋ ਬੰਦਾ ਖੂਹ ਵਿੱਚੋਂ ਪਾਣੀ ਕੱਢਣਾ ਚਾਹੁੰਦਾ ਹੈ ਉਹ ਬਾਲਟੀ ਨੂੰ ਖੂਹ ਵਿੱਚ ਸੁੱਟਦਾ ਹੈ ਅਤੇ ਰੱਸੀ ਰਾਹੀਂ ਉਹ ਬਾਲਟੀ ਉੱਤੇ ਖਿੱਚਦਾ ਹੈ ਜਿਸ ਨਾਲ ਪਾਣੀ ਆਮ ਬੰਦਾ ਕੱਢ ਸਕਦਾ ਹੈ ਪਰ ਆਧੁਨਿਕ ਯੰਤਰ ਰਾਹੀਂ ਇਹ ਹੋਰ ਵੀ ਸਹੂਲੀਅਤ ਨਾਲ ਕੱਢਿਆ ਜਾ ਸਕਦਾ ਹੈ ਸਾਨੂੰ ਇੱਕ ਯੰਤਰ ਦੀ ਲੋੜ ਹੈ ਜਿਸ ਰਾਹੀ ਅਸੀਂ ਉਸ ਬਾਲਟੀ ਨੂੰ ਬਟਨਾਂ ਦੇ ਥਰੂ ਉੱਤੇ ਅਤੇ ਥੱਲੇ ਕਰ ਸਕਦੇ ਹਨ ਜਿਵੇਂ ਕਿ ਇੱਕ ਬੰਦਾ ਖੂਹ ਵਿੱਚੋਂ ਪਾਣੀ ਕੱਢਣਾ ਚਾਹੁੰਦਾ ਹੈ ਉਹ ਥੱਲੇ ਵਾਲਾ ਬਟਨ ਦਬਾਏਗਾ ਜਿਹਦੇ ਰਾਹੀਂ ਬਾਲਟੀ ਨੀਚੇ ਜਾਵੇਗੀ ਅਤੇ ਆਪਣੇ ਆਪ ਹੀ ਉਹ ਜਦੋਂ ਬਾਲਟੀ ਭਰ ਜਾਵੇਗੀ ਤਾਂ ਉਹ ਉੱਤੇ ਵਾਲਾ ਬਟਨ ਦਬਾਵੇਗਾ ਉਸ ਯੰਤਰ ਵਿੱਚ ਜਿਹਦੇ ਨਾਲ ਬਾਲਟੀ ਉੱਪਰ ਨੂੰ ਆਵੇਗੀ ਅਤੇ ਇੱਕ ਬੰਦਾ ਪਾਣੀ ਆਸਾਨੀ ਨਾਲ ਕੱਢ ਸਕਦਾ ਹੈ ਅਤੇ ਉਹ ਪਾਣੀ ਅਸਲ ਜ਼ਿੰਦਗੀ ਵਿੱਚ ਚੰਗੀ ਤਰ੍ਹਾਂ ਨਾਲ ਵਰਤਿਆ ਵੀ ਜਾ ਸਕਦਾ ਹੈ ਅਤੇ ਬੰਦਿਆਂ ਨੂੰ ਜਾਂ ਔਰਤਾਂ ਨੂੰ ਕੋਈ ਤਕਲੀਫ ਹੀ ਨਹੀਂ ਦੇਵੇਗਾ